ਪੰਜਾਬੀ ਭਾਸ਼ਾ ਪਿੱਛੇ ਤੋਂ ਗੁਰਮੁਖੀ ਲਿਪੀ ਦੇ ਨਾਲ਼ ਸੰਬੰਧ ਰੱਖਦੀ ਹੈ ਪੰਜਾਬੀ ਲਿਖਣ ਬੋਲਣ ਲਈ ਸਭ ਤੋਂ ਜ਼ਿਆਦਾ ਗੁਰਮੁਖੀ ਲਿਪੀ ਆਉਣੀ ਚਾਹੀਦੀ ਹੈ ਪੰਜਾਬੀ ਭਾਸ਼ਾ ਦਾ ਵਿਕਾਸ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਪਹਿਲਾਂ ਤੋਂ ਹੁੰਦਾ ਆ ਰਿਹਾ ਹੈ ਅਤੇ ਗੁਰਮੀਲ ਗੁਰਮੁਖੀ ਲਿਪੀ ਦਾ ਸੁਧਾਰ ਗੁਰੂ ਅੰਗਦ ਸਾਡੇ ਗੁਰੂ ਸਿੱਖਾਂ ਦੇ ਦ ਦੂਜੇ ਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਕੀਤਾ ਸੀ ਅੱਜ ਕੱਲ੍ਹ ਦੇ ਸਮੇਂ ਦੇਖਿਆ ਜਾਵੇ ਤਾਂ ਪੰਜਾਬੀ ਅਜਿਹੀ ਭਾਸ਼ਾ ਹੈ ਜੋ ਕਿਸੇ ਹੋਰ ਦੂਜੀ ਭਾਸ਼ਾ ਨੂੰ ਜਿਉਂ ਦੀ ਤਿਉਂ ਲਿਖਣ ਲਈ ਕੰਮ ਕੀਤੀ ਜਾਂਦੀ ਹੈ ਜਿਵੇਂ ਜਿਵੇਂ ਦੇਗਨਾਗਰੀ ਲਿਪੀ ਦੇਖਿਆ ਜਾਵੇ ਹਿੰਦੀ ਹਿੰਦੀ ਦ ਲਿਪੀ ਦੇਵਨਾਗਰੀ ਨੂੰ ਦੇਖਿਆ ਜਾਵੇ ਤਾਂ ਜਿਉਂ ਦੀ ਤਿਉਂ ਅੱਖਰ ਲਿਖਣ ਲਈ ਸਾਨੂੰ ਦੋ ਦੋ ਅੱਖਰਾਂ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਪੰਜਾਬੀ ਵਿੱਚ ਅਜਿਹਾ ਨਹੀਂ ਹੈ ਪੰਜਾਬੀ ਭਾਸ਼ਾ ਪੜ੍ਹਨ ਵਿੱਚ ਵੀ ਆਸਾਨ ਹੈ ਅਤੇ ਇਹਦੀ ਵਿਆਕਰਨ ਵੀ ਸੌਖੀ ਹੈ ਜੇਕਰ ਕੋਈ ਸਿੱਖਣਾ ਚਾਹੁੰਦਾ ਤਾਂ ਪੰਜਾਬੀ ਭਾਸ਼ਾ ਨੂੰ ਆਸਾਨੀ ਨਾਲ਼ ਸਿੱਖ ਲੈਂਦਾ ਹੈ ਸਿੱਖਣ ਲਈ ਸਭ ਤੋਂ ਪਹਿਲਾਂ ਸਾਨੂੰ ਕਿਸੇ ਵੀ ਲੈਂਗੁਇਜ ਦੀ ਕਿਸੇ ਵੀ ਭਾਸ਼ਾ ਦੀ ਵਿਆਕਰਨ ਸਿੱਖਣੀ ਜ਼ਰੂਰੀ ਹੈ ਅਤੇ ਪੰਜਾਬੀ ਭਾਸ਼ਾ ਦੀ ਵਿਆਕਰਨ ਇੰਨੀ ਔਖੀ ਨਹੀਂ ਹੈ ਪੰਜਾਬੀ ਭਾਸ਼ਾ ਨੂੰ ਕੋਈ ਵੀ ਦੇਗਨਾਗ ਦੇਵਨਾਗ ਨਾਗਰੀ ਪੜ੍ਹਨ ਵਾਲਾ ਸੰਸਕ੍ਰਿਤ ਬ੍ਰਿੱਜ ਫਾਰਸ ਕੋਈ ਵੀ ਭਾਸ਼ਾ ਪੜ੍ਹਨ ਵਾਲਾ ਪੰਜਾਬੀ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ਼ ਅਤੇ ਛੇਤੀ ਸਿੱਖ ਜਾਂਦਾ ਹੈ ਪੰਜਾਬੀ ਵਿੱਚ ਪੈਂਤੀ ਅੱਖਰੀ ਜਿਵੇਂ ਊੜਾ ਪੈਂਤੀ ਅੱਖਰੀ ਊੜਾ ਆੜਾ ਈੜੀ ਹੁੰਦੀ ਹੈ ਉਹ ਵਰਨਮਾਲਾ ਹੈ ਪੰਜਾਬੀ ਦੀ ਉਹਨੂੰ ਪੈਂਤੀ ਅੱਖਰੀ ਵੀ ਕਹਿ ਦਿੰਦੇ ਆ ਅਤੇ ਅੱਜ ਕੱਲ੍ਹ ਪ ਪਿੱਛੇ ਜੇ ਆ ਕੇ ਇਸ ਵਿੱਚ ਪੰਜ ਨਵੇਂ ਸ਼ਬਦ ਜੋੜੇ ਗਏ ਆ ਬਿੰਦੀ ਲਾ ਕੇ ਉਸੇ ਅੱਖਰਾਂ ਨੂੰ ਵੀ ਫ਼ਾਰਸੀ ਦੇ ਸੰਸਕ੍ਰਿਤ ਦੇ ਭਾ ਸ਼ਬਦ ਬਣਾਉਣ ਲਈ ਪੰਜਾਬੀ ਭਾਸ਼ਾ ਅੱਜ ਲਈ ਬਹੁਤ ਹੀ ਬਹੁਤ ਹੀ ਅਤੇ ਵਧੀਆ ਭਾਸ਼ਾ ਮੰਨੀ ਜਾਂਦੀ ਹੈ